ਸਾਡੇ ਖੇਤਰ ਵਿੱਚ ਬਹੁਤ ਹੀ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰ ਹਨ ਜਿਵੇਂ ਕਿ ਸਰਕਾਰੀ ਹਸਪਤਾਲ ਪ੍ਰਾਈਵੇਟ ਹਸਪਤਾਲ ਅਤੇ ਏਮਜ਼ ਹੈ ਇਹਨਾਂ ਹਸਪਤਾਲਾਂ ਵਿੱਚ ਹਰੇਕ ਬਾਰੀ ਦਾ ਇਲਾਜ ਹੋ ਜਾਂਦਾ ਹੈ ਇਹ ਸਾਰੇ ਹਸਪਤਾਲ ਸਾਰੇ ਹਸਪਤਾਲ ਸਾਡੇ ਸ਼ਹਿਰ ਵਿੱਚ ਹਨ ਅਸੀਂ ਬਹੁਤ ਅਸਾਨੀ ਨਾਲ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਪਹੁੰਚ ਜਾਂਦੇ ਹਨ